ਕੀ ਤੁਸੀਂ ਇੱਕ ਮਨ ਪਸੰਦ ਭੰਗੜਾ ਐਰੋਬਿਕਸ ਰੂਟੀਨ ਦਾ ਵਰਣਨ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਭਾਗ ਲੈਣ ਦਾ ਆਨੰਦ ਲੈਂਦੇ ਹੋ ਕਿਹੜੀ ਚੀਜ਼ ਇਸ ਨੂੰ ਤੁਹਾਡੇ ਲਈ ਖਾਸ ਬਣਾਉਂਦੀ ਹੈ